ਰਾਜ ਦੀਆਂ ਅਧਿਆਤਮਿਕ ਪਰੰਪਰਾਵਾਂ ਦੇ ਅਨੁਭਵ ਕਰਨ ਦੇ ਬਹੁਤ ਸਾਰੇ ਤਰੀਕੇ ਹਨ ਜਿਸ ਤਰ੍ਹਾਂ ਕਿ ਹਰਿਮੰਦਰ ਸਾਹਿਬ ਹੈਗਾ ਉਹ ਅਧਿਆਤਮਿਕ ਦ੍ਰਿਸ਼ਟੀ ਨਾਲ ਬਹੁਤ ਮਹੱਤਵਪੂਰਨ ਹੈਗਾ ਦੇਸ਼ ਵਿਦੇਸ਼ ਤੋਂ ਲੋਕ ਹਰਿਮੰਦਰ ਸਾਹਿਬ ਆ ਕੇ ਮੱਥਾ ਟੇਕਦੇ ਹਨ ਅਤੇ ਆਪਣਾ ਅਨੁਭਵ ਸਾਂਝਾ ਕਰਦੇ ਹਨ ਅਤੇ ਇਸੇ ਤਰ੍ਹਾਂ ਰਾਮ ਤੀਰਥ ਹੈਗਾ ਮੰਦਰ ਅੰਮ੍ਰਿਤਸਰ ਦੇ ਵਿੱਚ ਹੀ ਲੋਕ ਉੱਥੇ ਵੀ ਜਾਂਦੇ ਹਨ ਅਤੇ ਆਪਣਾ ਅਧਿਆਤਮਿਕ ਅਨੁਭਵ ਉਹ ਲੈਂਦੇ ਹਨ ਅਤੇ ਜੇ ਅਸੀਂ ਅਨੰਦਪੁਰ ਸਾਹਿਬ ਵੱਲ ਜਾਈਏ ਤਾਂ ਹੋਲਾ ਮੁਹੱਲਾ ਬਹੁਤ ਮਸ਼ਹੂਰ ਹੈ ਤਾਂ ਲੋਕ ਆਪਣਾ ਹੋਲਾ ਮੁਹੱਲਾ ਉਡੀਕਦੇ ਹਨ ਅਤੇ ਉੱਥੇ ਤਿੰਨ ਜਾਂ ਚਾਰ ਦਿਨ ਉੱਥੇ ਰਹਿੰਦੇ ਹਨ ਅਤੇ ਇਹ ਜਿਹੜੀ ਪੂਰੀਆਂ ਪਰੰਪਰਾਵਾਂ ਨੂੰ ਦੇਖਦੇ ਹਨ ਅਤੇ ਆਪਣੇ ਜੀਵਨ ਵਿੱਚ ਨਿਭਾਉਂਦੇ ਹਨ ਅਤੇ ਉੱਥੇ ਅਨੰਦਪੁਰ ਸਾਹਿਬ ਵਿਖੇ ਕੋਲਜ ਵੀ ਹੈਗਾ ਉੱਥੇ ਸਿੱਖ ਸਟੱਡੀ ਦੇ ਕੋਰਸ ਵੀ ਕਰਾਏ ਜਾਂਦੇ ਹਨ ਅਤੇ ਇਸੇ ਤਰ੍ਹਾਂ ਜ਼ਿਲ੍ਹਾ ਜਲੰਧਰ ਵਿੱਚ ਦੇਵੀ ਤਲਾਬ ਮੰਦਰ ਹੈਗਾ ਅਤੇ ਜਿਹੜੇ ਵੀ ਲੋਕ ਜਲੰਧਰ ਸਾਈਡ ਜਾਂਦੇ ਹਨ ਤਾਂ ਉਹ ਉਸ ਮੰਦਰ ਦੇ ਦਰਸ਼ਨ ਜ਼ਰੂਰ ਕਰਦੇ ਹਨ ਅਤੇ ਇਸੇ ਤਰ੍ਹਾਂ ਹੀ ਇੱਕ ਪਸ਼ਨਾ ਟਰੇਨਿੰਗ ਰਿਸਰਚ ਇੰਸਟੀਚਿਊਟ ਹੈਗਾ ਹੁਸ਼ਿਆਰਪੁਰ ਦੇ ਵਿੱਚ ਅਤੇ ਜਿਸ ਨੂੰ ਵੀ ਮੌਕਾ ਮਿਲਦਾ ਹੈਗਾ ਉਹ ਉੱਥੇ ਜ਼ਰੂਰ ਆਪਣਾ ਅਟੈਂਡ ਕਰਦੇ ਹਨ ਪ੍ਰੋਗਰਾਮ ਅਤੇ ਇਸ ਤਰ੍ਹਾਂ ਰਾਜ ਵਿੱਚ ਜਿਹੜਾ ਅਧਿਆਤਮਿਕ ਪਰੰਪਰਾਵਾਂ ਉਹ ਉਹਨਾਂ ਦੀ ਪੂਰੀ ਪਾਲਣਾ ਕੀਤੀ ਜਾਂਦੀ ਹੈ ਚਾਹੇ ਕਿਸੇ ਵੀ ਧਰਮ ਨਾਲ ਹੋਵੇ ਮਜ਼੍ਹਬ ਨਾਲ ਹੋਵੇ ਅਤੇ ਲੋਕ ਉੱਥੇ ਆਪਣੇ ਸਹਿਚਾਰ ਨਾਲ ਜਾਂਦੇ ਹਨ ਅਤੇ ਕੁਛ ਨਾ ਕੁਝ ਅਧਿਆਤਮਿਕ ਤੌਰ 'ਤੇ ਸਿੱਖਦੇ ਰਹਿੰਦੇ ਹਨ